ਬਗ਼ੀਚੇ ਵਿੱਚ ਮਿੱਟੀ ਨਾ ਤਾਂ ਜ਼ਿਆਦਾ ਰੇਤਲੀ ਹੋਣੀ ਚਾਹੀਦੀ ਹੈ ਅਤੇ ਨਾ ਹੀ ਜ਼ਿਆਦਾ ਚੀਕਣੀ ਹੋਣੀ ਚਾਹੀਦੀ ਹੈ ਜਿਹੜੀ ਰੇਤਲੀ ਮਿੱਟੀ ਹੁੰਦੀ ਹੈ ਉਹਦੇ ਵਿੱਚ ਆਪਾਂ ਨੂੰ ਜ਼ਿਆਦਾ ਪਾਣੀ ਪਾਉਣਾ ਪੈਂਦਾ ਹੈ ਐਨਾ ਕਿਸੇ ਕੋਲ ਟਾਈਮ ਨਹੀਂ ਹੁੰਦਾ ਕਿ ਉਹਦੇ ਵਿੱਚ ਵਾਰ ਵਾਰ ਪਾਣੀ ਪਾਉ ਅਤੇ ਉਹਦੇ ਵਿੱਚ ਪਾਣੀ ਨਹੀਂ ਪਾਉਂਦੇ ਤਾਂ ਬੂਟਾ ਸੁੱਕ ਜਾਂਦਾ ਹੈ ਐਵੇਂ ਹੀ ਜਿਵੇਂ ਚੀਕਣੀ ਮਿੱਟੀ ਹੈ ਚੀਕਣੀ ਮਿੱਟੀ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ ਅਤੇ ਬੂਟੇ ਦੀਆਂ ਜੜ੍ਹਾਂ ਗਲ ਜਾਂਦੀਆਂ ਹਨ ਅਤੇ ਮੇਰੇ ਬਗ਼ੀਚੇ ਵਿੱਚ ਜ ਬਹੁਤ ਸਾਰੇ ਫੁੱਲ ਲੱਗੇ ਹੋਏ ਹਨ ਫੁੱਲ ਜਿਵੇਂ ਕੁਛ ਤਾਂ ਸਵੇਰੇ ਖਿੜਦੇ ਹੈ ਕੁਛ ਦੁਪਹਿਰ ਨੂੰ ਖਿੜਦੇ ਹੈ ਕੁਛ ਸ਼ਾਮ ਨੂੰ ਖਿੜਦੇ ਹੈ ਫੁੱਲ ਜਿਵੇਂ ਗੇਂਦੇ ਦਾ ਹੋ ਗਿਆ ਗੁਲਾਬ ਦਾ ਹੋ ਗਿਆ ਅਤੇ ਸਬਜ਼ੀਆਂ ਵਿੱਚ ਮੇਰੇ ਬਗ਼ੀਚੇ ਵਿੱਚ ਘੀਆ ਕੱਦੂ ਕਰੇਲੇ ਮੇਥੀ ਬਾਥੂ ਸਾਗ ਮੂਲੀਆਂ ਗੋਭੀ ਇਹ ਹਨ ਅਤੇ ਦੂ ਹੋਰ ਮੇਰੇ ਬਗ਼ੀਚੇ ਵਿੱਚ ਫ਼ਲ ਵੀ ਲੱਗੇ ਹੋਏ ਹਨ ਜਿਵੇਂ ਸੇਬ ਅਮਰੂਦ ਅੰਗੂਰ ਇਹ ਹਨ